ਮੈਂ ਅਕਸਰ ਹੀ ਯਾਤਰਾਵਾਂ ਕਰਦਾ ਰਹਿੰਦਾ ਹਾਂ ਘੁੰਮਣ ਫਿਰਨ ਨਾਲ ਜਿੱਥੇ ਵਿਅਕਤੀ ਨੂੰ ਰੋਜ਼ਾਨਾ ਦੇ ਰੁਝੇਵਿਆਂ ਵਿੱਚੋਂ ਕੁਝ ਪਲ ਰਾਹਤ ਮਿਲਦੀ ਹੈ ਉੱਥੇ ਕੁਦਰਤ ਵੱਲੋਂ ਸਿਰਜੀ ਸ੍ਰਿਸ਼ਟੀ ਦੇਖਣ ਦਾ ਵੀ ਮੌਕਾ ਮਿਲਦਾ ਹੈ ਬਹੁਤ ਜਗ੍ਹਾ 'ਤੇ ਜਾ ਕੇ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਜਿਸ ਨਾਲ ਬਹੁਤ ਤਰ੍ਹਾਂ ਦੇ ਜਿਹੜੇ ਏ ਦੁਨਿਆਵੀ ਬੰਦੇ ਨੂੰ ਰੁਝੇਵਿਆਂ ਨਾਲ ਜਿਹੜੀਆਂ ਮੁਸ਼ਕਿਲਾਂ ਸਾਹਮਣੇ ਆਉਂਦੀਆਂ ਹਨ ਉਹ ਤੋਂ ਰਾਹਤ ਮਿਲਦੀ ਹੈ ਇਸ ਤਰ੍ਹਾਂ ਆਮ ਹੀ ਜਦੋਂ ਵੀ ਸਮਾਂ ਮਿਲਦਾ ਹੈ ਆਪਣੇ ਕੰਮਾਂ ਵਿੱਚੋਂ ਤਾਂ ਮੈਂ ਅਕਸਰ ਹੀ ਯਾਤਰਾਵਾਂ ਨੂੰ ਜਾਂਦਾ ਰਹਿੰਦਾ ਹਾਂ ਕਈ ਵਾਰ ਯਾਰ ਦੋਸਤ ਵੀ ਇਹ ਨਾਲ ਹੁੰਦੇ ਹਨ ਅਤੇ ਜਿਸ ਦੇ ਨਾਲ ਜਿੱਥੇ ਦਿਲ ਦਿਮਾਗ ਨੂੰ ਸਕੂਨ ਮਿਲਦਾ ਹੈ ਉੱਥੇ ਕੁਦਰਤ ਵੱਲੋਂ ਨਿਵਾਜਿਆ ਸੰਸਾਰ ਵੀ ਦੇਖਣ ਨੂੰ ਮਿਲਦਾ ਹੈ